ਮੈਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਂਕ ਸੀ ਜਦੋਂ ਵੀ ਮੈਂ ਦੂਜੇ ਨੂੰ ਖਿਡਾਰੀਆਂ ਨੂੰ ਭੱਜਦੇ ਹੋਏ ਦੇਖਦੀ ਤਾਂ ਮੇਰੇ ਮਨ ਦੇ ਵਿੱਚ ਇਹ ਇੱਛਾ ਹੁੰਦੀ ਕਿ ਮੈਂ ਵੀ ਭੱਜਾ ਪਰ ਉਦੋਂ ਮੈਂ ਬਹੁਤ ਛੋਟੀ ਸੀ ਜਦੋਂ ਮੈਂ ਪੰਜਵੀਂ ਕਲਾਸ ਚ ਹੋਈ ਤਾਂ ਸਾਡੇ ਸਕੂਲ ਵਿੱਚ ਖੋਖੋ ਦੀ ਟੀਮ ਬਣੀ ਤੇ ਮੈਂ ਉਹਦੇ ਵਿੱਚ ਭਾਗ ਲਿਆ ਤੇ ਫਿਰ ਸਾਡਾ ਮੈਚ ਹੋਇਆ ਜਿਲੇ ਦੇ ਤੌਰ 'ਤੇ ਫਿਰ ਉਹਦੇ ਵਿੱਚ ਸਾਡੀ ਫਸਟ ਪੋਜੀਸ਼ਨ ਆਈ ਤੇ ਮੇਰੇ ਮਨ ਨੂੰ ਬਹੁਤ ਚੰਗਾ ਲੱਗਿਆ ਤੇ ਫਿਰ ਜਦੋਂ ਵੀ ਸਕੂਲ ਦੇ ਵਿੱਚ ਵਾਰ ਵਾਰ ਗੇਮਾਂ ਹੁੰਦੀਆਂ ਸੀ ਤਾਂ ਮੈਂ ਉਹਦੇ ਵਿੱਚ ਪਾਰਟੀਸਪੇਟ ਕਰਦੀ ਰਹੀ ਜਦੋਂ ਜਦੋਂ ਵੀ ਦੌੜਨਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਸੀਗਾ ਤੇ ਅੱਜ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਇਹ ਸਾਡਾ ਯੂਨੀਵਰਸਿਟੀ ਪੱਧਰ 'ਤੇ ਮੈਚ ਹੋਇਆ ਤੇ ਉਹਦੇ ਵਿੱਚ ਵੀ ਸਾਡੀ ਸੈਕਿੰਡ ਪੁਜੀਸ਼ਨ ਆਈ ਤੇ ਉਹਦੇ ਤੇ ਉਸ ਤੋਂ ਬਾਅਦ ਸਾਡੇ ਕਾਲਜ ਦੇ ਵਿੱਚ ਬਾਹਰ ਖੇਡਾਂ ਦਾ ਆਯੋਜਨ ਹੋਇਆ ਤੇ ਫਿਰ ਅਸੀਂ ਜੋ ਵੀ ਗੇਮ ਹੁੰਦੀ ਸੀ ਮੈਂ ਉਹਦੇ ਵਿੱਚ

ਤੇ ਇਹਦੇ ਵਿੱਚ ਇਹਦੇ ਨਾਲ ਸਰੀਰ ਦੇ ਵਿੱਚ ਸ਼ਕਤੀ ਆਉਂਦੀ ਆ ਤੇ ਜਦੋਂ ਵੀ ਅਸੀਂ ਖੇਡਾਂ ਦੇ ਵਿੱਚ ਭਾਗ ਲੈਦੇ ਆਂ ਸਾਡਾ ਸਰੀਰ ਤੰਦਰੁਸਤ ਰਹਿੰਦਾ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਕਰਦਾ ਗਾ ਮੈਂ ਮੈਨੂੰ ਵੀ ਇਹੀ ਰਹਿੰਦਾ ਸੀ ਕਿ ਮੈਂ ਜਿਆਦਾ ਤੋਂ ਜਿਆਦਾ ਖੇਡਾਂ ਵਿੱਚ ਭਾਗ ਲਵਾਂ ਤੇ ਪਹਿਲਾਂ ਪ੍ਰਾਈਜ ਲੈ ਕੇ ਆਵਾਂ